ਭਾਰਤ ਵਿੱਚ ਕਾਫ਼ੀ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜੇ ਕਈ ਅਲੱਗ ਅਲੱਗ ਨੇ ਮੈਂ ਕੁਛ ਰੈਸਪੀਆਂ ਜਿੱਥੇ ਕੁਛ ਚੀਜ਼ਾਂ ਅੱਜ ਤੁਹਾਡੇ ਨਾਲ਼ ਸ਼ੇਅਰ ਕਰਨਾ ਚਾਹੁੰਦੀ ਹਾਂ ਜਿਸ ਤਰ੍ਹਾਂ ਕਿ ਆਲੂ ਵਾਲੇ ਪਰੌਂਠੇ ਗੋਭੀ ਵਾਲੇ ਪਰੌਂਠੇ ਮੂਲੀਆਂ ਵਾਲੇ ਪਰੌਂਠੇ ਆਲੂ ਮਟਰ ਸ਼ਾਹੀ ਪਨੀਰ ਗੋਭੀ ਗਾਜਰਾਂ ਪਾਲਕ ਪਨੀਰ ਸਾਗ ਕਾਫ਼ੀ ਚੀਜ਼ਾਂ ਨੇ ਜੋ ਕਿ ਮੈਂ ਤੁਹਾਡੇ ਨਾਲ ਅੱਜ ਕੁਝ ਚੀਜ਼ਾਂ ਸ਼ੇਅਰ ਕਰਨਾ ਚਾਹੁੰਦੀ ਹਾਂ ਜਿਸ ਤਰ੍ਹਾਂ ਕਿ ਕੜੀ ਕੜੀ ਪਕੌੜਾ ਕ ਕੜੀ ਪ ਪਕੌੜਾ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਪਕੌੜੇ 'ਚ ਇੱਕ ਪਿਆਜ਼ ਮਟ ਪਿਆਜ਼ ਆਲੂ ਕੱਟ ਕੱਟ ਕੇ ਉਹਨਾਂ ਵਿੱਚ ਮਸਾਲੇ ਰਲਾਵਾਂਗੇ ਅਤੇ ਉਹਨਾਂ ਦੇ ਪਕੌੜੇ ਤੇਲ ਫਰਾਈ ਕਰਕੇ ਉਹਦੇ ਵਿੱਚ ਪਕੌੜੇ ਕੱਢ ਕੇ ਇੱਕ ਸਾਈਡ 'ਤੇ ਰੱਖ ਲਵਾਂਗੇ ਉਸ ਤੋਂ ਬਾਅਦ ਤੇਲ ਗਰਮ ਹੋਣ ਤੜਕੇ ਵਾਸਤੇ ਰੱਖਾਂਗੇ ਉਹਦੇ ਵਿੱਚ ਮੇਥੇ ਥੋੜ੍ਹਾ ਜਿਹਾ ਮੇ ਥੋੜ੍ਹੇ ਜਿਹੇ ਅਜ਼ਵੈਣ ਜ਼ੀਰਾ ਪਾ ਕੇ ਉਹਨਾਂ ਨੂੰ ਕਰਕੇ ਥੋੜ੍ਹਾ ਜਿਹਾ ਰੋਸਟਡ ਉਸ ਤੋਂ ਬਾਅਦ ਲਸਣ ਦਾ ਲਸਣ ਦਾ ਤੜਕਾ ਲਗਾਵਾਂਗੇ ਫਿਰ ਆਲੂ ਫਿਰ ਪਿਆਜ਼ ਪਾਵਾਂਗੇ ਪਿਆਜ਼ਾਂ ਨੂੰ ਥੋੜ੍ਹਾ ਜਿਹਾ ਭੁੰਨ ਕੇ ਫਿਰ ਟਮਾਟਰ ਮਿਰਚਾਂ ਕਰਕੇ ਉਹਦੇ ਵਿੱਚ ਕਰੈਂਮਕ ਚੱਜ ਨਾਲ਼ ਮਸਾਲਾ ਕਰਕੇ ਥੋੜ੍ਹਾ ਜਿਹਾ ਤਿਆਰ ਫਿਰ ਉਹਦੇ ਵਿੱਚ ਇੱਕ ਪਾਸੇ ਲੱਸੀ ਚਾਹੇ ਇਮਲੀ ਦਾ ਘੋਲ ਵੀ ਤੁਸੀਂ ਤਿਆਰ ਕਰ ਸਕਦੇ ਹੋ ਵੇਸਨ ਪਾ ਕੇ ਫਿਰ ਆਪਾਂ ਉਹਨੂੰ ਤੜਕੇ ਵਿੱਚ ਪਾ ਦੇਵਾਂਗੇ ਉਹਦੇ ਵਿੱਚ ਪਾਣੀ ਮਿਲਾ ਕੇ ਉਹਨੂੰ ਕੁਛ ਟਾਈਮ ਲਈ ਰਿੱਝਣ ਲਈ ਰੱਖ ਦੇਵਾਂਗੇ ਉਹਦੇ ਵਿੱਚ ਤੁਸੀਂ ਅਤੇ ਆਪਣੇ ਸਵਾਦ ਅਨੁਸਾਰ ਧਨੀਆ ਕੱਟ ਕੇ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਜੋ ਪਕੌੜੇ ਤਿਆਰ ਕੀਤੇ ਨੇ ਹੁਣ ਉਹਨਾਂ ਨੂੰ ਵਿੱਚ ਸੁੱਟ ਕੇ ਨਾਲ਼ ਚਾਵਲ ਉਬਾਲ ਕੇ ਚਾਵਲ ਨਾਲ਼ ਰੈਸਪੀ ਖਾਣ ਵਾਸਤੇ ਦੇ ਸਕਦੇ ਹੋ ਮੈਂ ਹ ਇਸ ਤਰ੍ਹਾਂ ਇਹ ਕੜੀ ਬਣਾਈ ਜਾਂਦੀ ਹੈ ਸਾਗ ਵੀ ਸਾਗ ਵੀ ਕਾਫ਼ੀ ਪ੍ਰਚਲਿਤ ਹੈ ਸਾਗ ਨੂੰ ਪਹਿਲਾਂ ਲਿਆਵਾਂਗੇ ਧੋ ਕੇ ਫਿਰ ਉਹਨਾਂ ਨੂੰ ਕੱਟ ਕੇ ਕੁੱਕਰ ਚੁੱਲ੍ਹੇ 'ਤੇ ਚਾਹੇ ਕੁੱਕਰ ਵਿੱਚ ਗੈਸ 'ਤੇ ਤੁਸੀਂ ਕਿਸੇ ਵੀ ਤਰ੍ਹਾਂ ਤਿਆਰ ਕਰ ਸਕਦੇ ਹੋ ਉਸਨੂੰ ਪਾ ਕੇ ਰਿੱਝਣ ਲਈ ਰੱਖ ਦੇਵਾਂਗੇ ਉਹਦੇ ਕੁਛ ਕੁਛ ਟਾਈਮ ਦੀ ਵੇਖੀ ਜਾਵਾਂਗੇ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਪਾਣੀ ਥੋੜ੍ਹਾ ਥੋੜ੍ਹਾ ਕਰਕੇ ਐਡ ਕਰਾਂਗੇ ਉਸ ਤੋਂ ਬਾਅਦ ਉਹਦੇ ਵਿੱਚ ਇੱਕ ਘੋਲ ਬਣਾਇਆ ਜਾਵੇਗਾ ਚਾਹੇ ਮੱਕੀ ਦੇ ਆਟੇ ਦਾ ਬਣਾ ਲਉ ਚਾਹੇ ਕਣਕ ਦੇ ਦਾ ਉਹਦੇ ਵਿੱਚ ਘੋਲ ਪਾ ਕੇ ਫਿਰ ਉਹਨੂੰ ਘੋਟਿਆ ਜਾਵੇਗਾ ਘੋਟ ਕੇ ਫਿਰ ਤੁਸੀਂ ਤੇਲ ਨੂੰ ਸੜਨ ਵਾਸਤੇ ਰੱਖ ਦਿਉ ਉਹਦੇ ਵਿੱਚ ਲਸਣ ਦਾ ਪੇਸਟ ਤਿਆਰ ਕਰਕੇ ਪਹਿਲਾਂ ਉਹਨੂੰ ਕਰਨਾ ਥੋੜ੍ਹਾ ਜਿਹਾ ਰੋਸਟਡ ਉਸ ਤੋਂ ਬਾਅਦ ਪਿਆਜ਼ ਟਮਾਟਰ ਅਦਰਕ ਦਾ ਪ ਮਿਰਚਾਂ ਦਾ ਪੇਸਟ ਪਾ ਕੇ ਉਹਦਾ ਤੜਕਾ ਸਾਗ ਨੂੰ ਉਹਦੇ ਵਿੱਚ ਪਾਇਆ ਜਾਵੇਗਾ ਇਸ ਤਰ੍ਹਾਂ ਸਾਗ ਤਿਆਰ ਹੋਏਗਾ ਇਹ ਮੈਂ ਕੁਛ ਰੈਸਪੀ ਤੁਹਾਡੇ ਨਾਲ਼ ਸਾਂਝੀ ਕੀਤੀ ਹੈ